ਭਵਿੱਖ ਵਿੱਚ ਅਸੀਂ ਪੰਜਾਬ ਵਿੱਚ ਮਨੋਰੰਜਨ ਉਦਯੋਗ ਵਿੱਚ ਬਹੁਤ ਮੁੱਖ ਰੁਝਾਨਾਂ ਅਤੇ ਤਬਦੀਲੀਆਂ ਨੂੰ ਦੇਖ ਪਾ ਰਹੇ ਹਾਂ ਜਿਵੇਂ ਸਾਨੂੰ ਪੰਜਾਬ ਬਹੁਤ ਹੀ ਤਰੱਕੀ ਕਰਦਾ ਜਾਪਦਾ ਹੈ ਅੱਜ ਕੱਲ ਹਰ ਥਾਂ ਉੱਤੇ ਆਰਟੀਫਿਸ਼ਲ ਇੰਟੈਲੀਜੈਂਸ ਜਿਹਨੂੰ ਏ ਆਈ ਵੀ ਕਿਹਾ ਜਾਂਦਾ ਹੈ ਕਾਫੀ ਵਰਤੋਂ ਕੀਤੀ ਜਾਂਦੀ ਹੈ ਅੱਜ ਕੱਲ ਹੋਟਲਾਂ ਰੈਸਟੋਰੈਂਟਾਂ ਵਿੱਚ ਵੀ ਏ ਆਈ ਦੀ ਕਾਫੀ ਵਰਤੋਂ ਹੈ ਅਤੇ ਇਹ ਕਾਫੀ ਸਹਾਇਕ ਵੀ ਪ੍ਰਤੀਤ ਹੁੰਦਾ ਹੈ ਜਿਵੇਂ ਹੋਟਲਾਂ ਰੈਸਟੋਰੈਂਟਾਂ ਵਿੱਚ ਬਹਿਰੇ ਦੀ ਥਾਂ ਏ ਆਈ ਨੂੰ ਵੇਟਰ ਬਣਾ ਕੇ ਰੱਖਿਆ ਜਾਂਦਾ ਹੈ ਜੋ ਕਿ ਮਲ ਸਾਨੂੰ ਉੱਥੇ ਸਰਵ ਕਰਦੀ ਹੈ ਸਰਵਿਸ ਦਿੰਦੀ ਹੈ ਜੋ ਕਾਫੀ ਸਹਾਇਕ ਪ੍ਰਤੀਤ ਹੁੰਦੀ ਹੈ ਇਸ ਨਾਲ ਜੇ ਸਾਨੂੰ ਲਾਭ ਬਹੁਤ ਹਨ ਤਾਂ ਇਸ ਦੇ ਨਾਲ ਨਾਲ ਸਾਨੂੰ ਨੁਕਸਾਨ ਵੀ ਬਹੁਤ ਹਨ ਪਰੰਤੂ ਆਉਣ ਵਾਲਾ ਭਵਿੱਖ ਵਿੱਚ ਪੰਜਾਬ ਸਾਨੂੰ ਕਾਫੀ ਤਰੱਕੀ ਜਾਪਦਾ ਅੱਜ ਕੱਲ ਏ ਆਈ ਆਰਟੀਫਿਸ਼ਲ ਇੰਟੈਲੀਜੈਂਸ ਹਰ ਥਾਂ 'ਤੇ ਯੂਜ ਹੋ ਰਹੀ ਹੈ ਅਤੇ ਬਹੁਤ ਹੀ ਹੈਲਪਫੁਲ ਵੀ ਹੈ ਸਾਡੇ ਲਈ ਧੰਨਵਾਦ